ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਤੇਜਪਾਲਜੀਤ ਸਿੰਘ ਆ ਵੈਸੇ ਤਾਂ ਮੈਂ ਆਪਣੇ ਪੂਰੇ ਜੀਵਨ ਵਿੱਚ ਕਦੀ ਕੋਈ ਯੂ ਐੱਫ ਓਜ ਨੋਟ ਤਾਂ ਨਹੀਂ ਕੀਤਾ ਪਰ ਮੇਰੀ ਇਹ ਧਾਰਨਾ ਹੈ ਕਿ ਹੋਰ ਵੀ ਸਾਡੇ ਵਾਯੂਮੰਡਲ ਵਿੱਚ ਕਈ ਤਰ੍ਹਾਂ ਦੇ ਹੋਰ ਗ੍ਰਹਿ ਹਨ ਜਿਨ੍ਹਾਂ 'ਤੇ ਜੀਵਨ ਮੈਨੂੰ ਲੱਗਦਾ ਹੈ ਕਿ ਬਹੁਤ ਸੰਭਵ ਹੈ ਜਿਨ੍ਹਾਂ 'ਤੇ ਹੋਰ ਵੀ ਕਈ ਸ਼ਾਇਦ ਪ੍ਰਾਣੀ ਰਹਿੰਦੇ ਹੋਣ ਮੈਨੂੰ ਇਹ ਆਪਣੇ ਮੇਰੇ ਵਿਚਾਰ ਹਨ ਮੇਰੀ ਵਿਚਾਰਧਾਰਾ ਹੈਗੀ ਆ ਮੈਨੂੰ ਲੱਗਦਾ ਹੈ ਕਿ ਹੈ ਹੁੰਦੇ ਹਨ ਅਤੇ ਇਹ ਬਹੁਤ ਵੱ ਵੱਡੀ ਗੱਲ ਹੈ ਅਤੇ ਸਾਡੇ ਸ਼ਾਇਦ ਭਵਿੱਖ ਵਿੱਚ ਸਾਡੇ ਲੋਕ ਸਾਡੇ ਆ ਕੀ ਕਹਿੰਦੇ ਆ ਉਨ੍ਹਾਂ ਨੂੰ ਸਾਇੰਟਿਸਟ ਉੱਥੇ ਤੱਕ ਪਹੁੰਚ ਜਾਣ ਇਹ ਬਹੁਤ ਵਧੀਆ ਹੈ ਅਤੇ ਮੇਰੀ ਤਾਂ ਇਹੀ ਕਹਿਣਾ ਹੈ ਕਿ ਸਾਨੂੰ ਉਹਨਾਂ ਬਾਰੇ ਜਾਣਨਾ ਚਾਹੀਦਾ ਹੈ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਸਾਡੇ ਦੀ ਬਹੁਤ ਜ਼ਰੂਰੀ ਹੈ ਅਤੇ ਬਹੁਤ ਵਧੀਆ ਵੀ ਹੈ ਕਿ ਸਾਨੂੰ ਹੋਰ ਬਾਰੇ ਪਤਾ ਲੱਗੇ ਹੋਰ ਗ੍ਰਹਿਆਂ ਬਾਰੇ ਪਤਾ ਲੱਗੇ ਅਤੇ ਉਹਨਾਂ 'ਤੇ ਜੀਵਨ ਬਾਰੇ ਸਾਨੂੰ ਪਤਾ ਲੱਗੇ ਅਤੇ ਸਾਨੂੰ ਪਤਾ ਲੱਗੇ ਕਿ ਅਸੀਂ ਹੋਰ ਕਿਸ ਤਰ੍ਹਾਂ ਤਰੱਕੀ ਕਰ ਸਕਦੇ ਹਾਂ ਉਹਨਾਂ ਨੂੰ ਕਿੱਦਾਂ ਕੋਂਟੈਕਟ ਕਰ ਸਕਦੇ ਉਹਨਾਂ ਬਾਰੇ ਕਿੱਦਾਂ ਜਾਣ ਸਕਦੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਸਾਡੇ ਭਾਰਤ ਵਿੱਚ ਸਾਡੇ ਸਾਇੰਟਿਸਟ ਹੁਣ ਤੱਕ ਜ਼ਰੂਰ ਪਹੁੰਚਣਗੇ ਅਤੇ ਉਹਨਾਂ ਬਾਰੇ ਪਤਾ ਲਗਾਉਣਗੇ ਜਿਨ੍ਹਾਂ ਤੋਂ ਸਾਨੂੰ ਹੋਰ ਵੀ ਕਈ ਤਰ੍ਹਾਂ ਦੇ ਵਧੀਆ ਤੋਂ ਵਧੀਆ ਹੱਲ ਮਿਲਣਗੇ ਜੋ ਕਿ ਬਹੁਤ ਵਧੀਆ ਹਨ ਧੰਨਵਾਦ